ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਸਾਨੂੰ ਜੋ ਲੋਕ ਨੇ ਰੈਡੀਮੇਡ ਕੱਪੜੇ ਨੂੰ ਜ਼ਿਆਦਾ ਪ੍ਰੈਫਰ ਕਰਦੇ ਹਨ ਉਹ ਦੁਕਾਨਾਂ ਤੋਂ ਜਾ ਕੇ ਆਪਣੇ ਮਾਪ ਦੇ ਕੱਪੜੇ ਲੈ ਆਉਂਦੇ ਹਨ ਜਿਨ੍ਹਾਂ ਵਿੱਚ ਕੋਈ ਜ਼ਿਆਦਾ ਖਰਚ ਵਗੈਰਾ ਨਹੀਂ ਹੁੰਦਾ ਸਿਰਫ ਆਪੇ ਸੂਟ ਦਾ ਰੇਟ ਦੇ ਕੇ ਉਹਨਾਂ ਨੂੰ ਲੈ ਆਉਂਦੇ ਆ ਜੇ ਅਸੀਂ ਹੈਂਡਮੈਟ ਸੂਟ ਦੀ ਗੱਲ ਕਰੀਏ ਤਾਂ ਉਹਦੇ 'ਤੇ ਸਾਨੂੰ ਕੱਪੜਾ ਆਪ ਲੈ ਕੇ ਸਿਲਾਈ ਕਢਵਾਈ ਸਾਰਾ ਕੁਛ ਆਪ ਕਰਵਾਉਣਾ ਪੈਂਦਾ ਹੈ ਜਿਸ 'ਤੇ ਬਹੁਤ ਖਰਚ ਆਉਂਦਾ ਹੈ ਤਾਂ ਲੋਕ ਕੀ ਕਰਦੇ ਹਨ ਤਾਂ ਬਾਹਰੋਂ ਕੱਪੜਾ ਲੈਣਾ ਜ਼ਿਆਦਾ ਪ੍ਰੈਫਰ ਕਰਦੇ ਹਨ ਪਰ ਉਹਦੇ ਵਿੱਚ ਜੋ ਆਪਣੀ ਫਿਟਿੰਗ ਦਾ ਉਹਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਟ ਆ ਜਾਂਦਾ ਹੈ ਕਈ ਵਾਰੀ ਸਾਨੂੰ ਖੁਦ ਆਪ ਪੈਸੇ ਦੇ ਕੇ ਉਸਦੀ ਫਿਟਿੰਗ ਕਰਵਾਉਣੀ ਪੈਂਦੀ ਹੈ ਪਰ ਜੋ ਸੂਟ ਅਸੀਂ ਹੈਂਡਮੈਂਟ ਬਣਵਾਉਂਦੇ ਹਾਂ ਉਹਨਾਂ ਦੀ ਸਟੀਚਿੰਗ ਅਸੀਂ ਆਪਣੇ ਹਿਸਾਬ ਨਾਲ ਪਹਿਲਾਂ ਹੀ ਬਣਵਾ ਸਕਦੇ ਹਾਂ ਇਸ ਵਿੱਚ ਸਾਨੂੰ ਇੱਦਾਂ ਦੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਤੇ ਉਸ ਤੋਂ ਸੂਟ ਨੂੰ ਅਸੀਂ ਆਪਣੇ ਅਕੋਡਿੰਗ ਉਸਦੀ ਸਿਲਾਈ ਕਢਾਈ ਜੋ ਵੀ ਹੈ ਉਸਨੂੰ ਅਸੀਂ ਆਪਣੇ ਅਕੋਡਿੰਗ ਬਣਵਾ ਸਕਦੇ ਹਾਂ